ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਕੋਈ ਖਾਸ ਕਲਾਕਾਰ ਜਾਂ ਖਿਲਾਫਣ ਨਹੀਂ ਦਿਸਦੇ ਮੈਨੂੰ ਪ੍ਰਭਾਵਿਤ ਨਾ ਕੀਤਾ ਹੋਵੇ ਪਰ ਮੈਂ ਬਹੁਤ ਸਾਰੇ ਰੂਪਾਂ ਅਤੇ ਕਲਾਕਾਰਾਂ ਦੀ ਇੱਜ਼ਤ ਕਰਦਾ ਹਾਂ ਕਲਾ ਦੇ ਵੱਖਰੇ ਵੱਖਰੇ ਰੂਪ ਹੁੰਦੇ ਹਨ ਜਿਵੇਂ ਕਿ ਦੇਖਣ ਵਾਲੀ ਕਲਾ ਪੇਂਟਿੰਗ ਅਤੇ ਫੋਟੋਗ੍ਰਾਫੀ ਇੱਕ ਗਾਉਣ ਵਾਲੀ ਕਲਾ ਹੁੰਦੀ ਹੈ ਗੀਤ ਕਵਿਤਾ ਨਾਵਲ ਇਹਨਾਂ ਦੀ ਕਲਾ ਸਾਨੂੰ ਬਹੁਤ ਪ੍ਰਭਾਵਿਤ ਕਰਦੀ ਕਿਸੇ ਵੀ ਕੋਈ ਵੀ ਮਤਲਬ ਖੇਤਰ ਦੇ ਵਿੱਚ ਕਿਸੇ ਵੀ ਕੋਈ ਵੀ ਹਰ ਇੱਕ ਮਤਲਬ ਖੇਤਰ ਦੇ ਵਿੱਚ ਚਾਹੇ ਉਹ ਗ ਗਾਉਣ ਵਾਲਾ ਹੈ ਚਾਹੇ ਉਹ ਮਤਲਬ ਕਿ ਕੋਈ ਨਾਵਲਕਾਰ ਹੈ ਚਾਹੇ ਉਹ ਕੋਈ ਮਤਲਬ ਗੀਤਕਾਰ ਹੈ ਕੋਈ ਵੀ ਮਤਲਬ ਜਾਂ ਕੋਈ ਕਿਸੇ ਕਿਸਮ ਦੀ ਕੋਈ ਫੋਟੋਗ੍ਰਾਫੀ ਹੈ ਕੋਈ ਪੇਂਟਿੰਗ ਕਰਨ ਵਾਲਾ ਕੋਈ ਵਧੀਆ ਪੇਂਟਰ ਹੈ ਹਰ ਇੱਕ ਕਲਾ ਨੂੰ ਮੈਂ ਦਿਲੋਂ ਸਤਿਕਾਰ ਕਰਦਾ ਆਸ 'ਤੇ ਮੇਰਾ ਧੰਨਵਾਦ ਜੀ